ਹੈਲੋ ਊਬਰ ਕੈਬ ਬੁਕਿੰਗ ਏਜੰਸੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੰਚਨ ਹੈ ਕੱਲ੍ਹ ਮੈਂ ਆਪ ਜੀ ਪਾਸੋਂ ਇੱਕ ਕੈਬ ਬੁੱਕ ਕੀਤੀ ਸੀ ਪੰਜਾਬ ਰਾਜ ਤੋਂ ਬਾਹਰ ਜਾਣ ਲਈ ਪਰ ਮੇਰੀ ਮੀਟਿੰਗ ਕੈਂਸਲ ਹੋਣ ਕਰਕੇ ਇਹ ਬੁਕਿੰਗ ਮੈਨੂੰ ਕੈਂਸਲ ਕਰਨੀ ਪੈ ਰਹੀ ਹੈ ਇਸ ਬੁਕਿੰਗ ਦਾ ਐਡਵਾਂਸ ਭੁਗਤਾਨ ਜੋ ਕਿ ਦੋ ਹਜ਼ਾਰ ਰੁਪਏ ਸੀ ਮੈਂ ਆਪਣੇ ਗੂਗਲ ਪੇ ਅਕਾਊਂਟ ਦੇ ਰਾਹੀਂ ਕੀਤਾ ਸੀ ਮੈਂ ਚਾਹੁੰਦੀ ਹਾਂ ਕਿ ਮੇਰੀ ਐਡਵਾਂਸ ਪੇਮੈਂਟ ਮੈਨੂੰ ਰਿਫੰਡ ਕਰ ਦਿੱਤੀ ਜਾਵੇ ਤੁਸੀਂ ਇਹ ਰਿਫੰਡ ਟ੍ਰਾਂਸਫਰ ਮੇਰੇ ਗੂਗਲ ਪੇ ਅਕਾਊਂਟ ਰਾਹੀਂ ਜਿਸ ਰਾਹੀਂ ਮੈਂ ਐਡਵਾਂਸ ਭੁਗਤਾਨ ਕੀਤਾ ਸੀ ਉਸ ਰਾਂਹੀ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹ ਰਿਫੰਡ ਟ੍ਰਾਂਸਫਰ ਮੇਰੇ ਬੈਂਕ ਖਾਤੇ ਵਿੱਚ ਵੀ ਕਰ ਸਕਦੇ ਹੋ